ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਜਿਹੜਾ ਹੈ ਔਰਤਾਂ ਨੂੰ ਜਿਹੜਾ ਹੈ ਉਹ ਘਰ ਤੋਂ ਬਾਹਰ ਜਿਹੜਾ ਕੰਮ ਨਹੀਂ ਕਰਨ ਦਿੱਤਾ ਜਾਂਦਾ ਸੀ ਨਾ ਹੀ ਉਹਨਾਂ ਨੂੰ ਪ ਪੜ੍ਹਨ ਦਿੱਤਾ ਜਾਂਦਾ ਸੀ ਉਹਨਾਂ ਨੂੰ ਹੁੰਦਾ ਸੀ ਕਿ ਵੀ ਘਰ ਦਾ ਕੰਮ ਹੀ ਕਰਨ ਅਤੇ ਬਾਹਰ ਨਹੀਂ ਜਾ ਸਕਦੀਆਂ ਅਤੇ ਪੇਂਡੂ ਖੇਤਰ ਦੇ ਲੋਕਾਂ ਦੇ ਵਿੱਚ ਵੀ ਜਿਹੜਾ ਸੀ ਅਤੇ ਸਕੂਲ ਨਹੀਂ ਹੁੰਦੇ ਸੀ ਹੁੰਦੇ ਅਤੇ ਲੋਕ ਜਿਹੜੇ ਉਹ ਬਾਹਰ ਨਹੀਂ ਆ ਜਾ ਸਕਦੇ ਸੀਗੇ ਅਤੇ ਨਾ ਬਹੁਤਾ ਪੜ੍ਹ ਸਕਦੇ ਸੀ ਸਿੱਖਿਆ ਗ੍ਰਹਿਣ ਕਰ ਸਕਦੇ ਸੀਗੇ ਪਰ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੈ ਔਰਤਾਂ ਜਿਹੜੀਆਂ ਹੈ ਜਾਂ ਉਹ ਸਿੱਖਿਆ ਵੀ ਪ੍ਰਾਪਤ ਕਰ ਰਹੀਆਂ ਹੈ ਔਰ ਮਤਲਵ ਘਰ ਵੀ ਸਾਂਭ ਰਹੀਆਂ ਨੇ ਅਤੇ ਬਾਹਰ ਵੀ ਨੌਕਰੀ ਕਰ ਰਹੀਆਂ ਨੇ ਅਤੇ ਪੇਂਡੂ ਖੇਤਰ ਦੇ ਵਿੱਚ ਵੀ ਜਿਹੜਾ ਹੈ ਮਤਲਬ ਲੋਕ ਜਿਹੜੇ ਆ ਉਹ ਸਿੱਖਿਆ ਗ੍ਰਹਿਣ ਕਰਕੇ ਸ਼ਹਿ ਮਤਲਬ ਜਿਹੜਾ ਹੈ ਸ਼ਹਿਰੀ ਇਲਾਕੇ ਦੇ ਵਿੱਚ ਜਾ ਰਹੇ ਹਨ ਪ ਪਰ ਹਾਂਜੀ ਮੈਂ ਬਿਲਕੁਲ ਇਹਦੇ ਨਾਲ ਮਤਲਬ ਮਤਲਵ ਸਹਿਮਤ ਹਾਂ ਕਿ ਅੱਜ ਕੱਲ੍ਹ ਜਿਹੜਾ ਹੈ ਔਰਤਾਂ ਅਤੇ ਪੇਂਡੂ ਖੇਤਰ ਦੇ ਲੋਕਾਂ ਦੇ ਲਈ ਜਿਹੜਾ ਹੈ ਯੂਨੀਵਰਸਿਟੀਆਂ ਦੇ ਵਿੱਚ ਜਾਂ ਕੋਲਜਾਂ ਦੇ ਵਿੱਚ ਜਿਹੜਾ ਹੈ ਇੱਕ ਮਤਲਬ ਰਾਖਵਾਂਕਰਨ ਕੀਤਾ ਗਿਆ ਹੈ ਜਿਸ ਦੇ ਵਿੱਚ ਜਿਹੜਾ ਹੈ ਅ ਉਹਨਾਂ ਉਹ ਪਰਰਸੈਂਟ ਜਿਹੜਾ ਹੈ ਉਹ ਉਹਨਾ ਔਰਤਾਂ ਦੀ ਔਰ ਲੋਕ ਅ ਪਿੰਡ ਖੇਤਰ ਦੇ ਲੋਕਾਂ ਲਈ ਅ ਰੱਖਿਆ ਗਿਆ ਹੈ ਤਾਂ ਕਿ ਉਹ ਲੋਕ ਵੀ ਜਿਹੜਾ ਹੈ ਇੱਥੇ ਆ ਕੇ ਸਿੱਖਿਆ ਗ੍ਰਹਿਣ ਕਰ ਸਕਣ ਔਰ ਆਪਣੇ ਜਿਹੜੇ ਹੈ ਅੱਗੇਅ ਰੁਜ਼ਗਾਰ ਦੇ ਮੌਕੇ ਜਿਹੜੇ ਆਪਣੇ ਲਈ ਉਹ ਵਧਾ ਸਕਣ ਅਤੇ ਇਸ ਮਤਲਬ ਔਰਤਾਂ ਜਿਹੜੀਆਂ ਹੈ ਉਹ ਕੋਈ ਵੀ ਜਿਹੜਾ ਅ ਵਪਾਰ ਜਿਹੜਾ ਹੈ ਉਹ ਘਰੇਲੂ ਜਿਹੜਾ ਵਪਾਰ ਉਹ ਵੀ ਕਰ ਸਕਦੀਆਂ ਇਸ ਸਿੱਖਿਆ ਗ੍ਰਹਿਣ ਕਰਕੇ